ਹੈਲੋ ਹਾਂਜੀ ਹਾਂਜੀ ਕਿਵੇਂ ਕਮ ਹਾਂਜੀ ਹਾਂਜੀ ਮੈਂ

ਅੱਛਾ ਜੀ ਅੱਛਾ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਅਤੇ ਪਰ ਮੈਂ ਆਪਣਾ ਵੇਖੂੰਗੀ ਜੀ ਕੱਲ੍ਹ ਮੇਰੇ ਬੱਚੇ ਦੀ ਮੀਟਿੰਗ ਹੈ ਪੇਰੈਂਟਸ ਮੀਟਿੰਗ ਆ ਅਤੇ ਮੈਂ ਉੱਥੇ ਵੀ ਜਾਣਾ ਜ਼ਰੂਰੀ ਹੈ ਜੀ ਇਹ ਘਰ ਨਹੀਂ ਸੀਗੇ ਜੀ ਤਾਂ ਕਰਕੇ ਮੈਨੂੰ ਆਪ ਹੀ ਜਾਣਾ ਜ਼ਰੂਰੀ ਹੈ ਅਤੇ ਉਹ ਮੀਟਿੰਗ ਦੇਖ ਕੇ ਫਿਰ ਮੈਂ ਵੇਖਦੀ ਹਾਂ ਵੀ ਆਪਦਾ ਅਤੇ ਵੀ ਉੱਥੋਂ ਸਕੂਲੋਂ ਸਾਰਾ ਦੇਖ ਪੁੱਛ ਪਾਛ ਕੇ ਆਉਣਾ ਵੀ ਕਿਵੇਂ ਹਿਸਾਬ ਕਿਤਾਬ ਕਿਵੇਂ ਆ ਗੱਲਬਾਤ ਅਤੇ ਫਿਰ ਕੋਈ ਨਹੀਂ ਜੀ ਫਿਰ ਮੈਂ ਆਪਣਾ ਵੇਖੂੰਗੀ ਆ ਕਿਵੇਂ ਵੀ ਮੈਨੂੰ ਸੈਟਿੰਗ ਕਿਸ ਤਰ੍ਹਾਂ ਆਉਂਦੀ ਹੈ ਫਿਰ ਮੈਂ ਸੁਬਹਾ ਤੁਹਾਨੂੰ ਕਰ ਦੂੰਗੀ ਕਾਲ ਵੀ ਮੈਂ ਆ ਸਕਦੀ ਹਾਂ ਜਾਂ ਨਹੀਂ ਆ ਸਕਦੀ ਪਰ ਮੈਂ ਕੋਸ਼ਿਸ਼ ਇਹੀ ਕਰੂੰਗੀ ਕਿ ਮੈਂ ਤੁਹਾਡੇ ਘਰ ਪਹੁੰਚ ਸਕਾਂ ਕੋਈ ਨਹੀਂ ਜੀ ਉਹ ਤਾਂ ਗੱਲ ਹੀ ਨਹੀਂ ਕੋਈ ਨਾ ਹਾਂਜੀ ਹਾਂਜੀ ਹਾਂਜੀ ਮੈਂ ਕਿਤੇ ਬਾਜ਼ਾਰ ਹਾਂਜੀ ਹਾਂਜੀ ਹਾਂਜੀ ਹਾਂਜੀ ਚਲੋ ਕੋਈ ਨਹੀਂ ਜੀ ਇਹ ਤਾਂ ਇਹਦਾ ਵੀ ਹੱਲ ਮੈਂ ਕਰ ਦੂੰ ਪਰ ਸਾਡੇ ਘਰ ਵੀ ਕਿਸੇ ਨੇ ਮਹਿਮਾਨ ਨੇ ਆਉਣਾ ਸੀ ਚੱਲ ਉਹਨਾਂ ਨੂੰ ਮੈਂ ਕੱਲ੍ਹ ਦਾ ਦਿਨ ਕਹਿ ਕੇ ਪਰਸੋਂ ਕਹਿ ਦਿੰਦੀ ਹਾਂ ਵੀ ਚਲੋ ਉਹ ਪਰਸੋਂ ਆ ਜਾਣਗੇ ਤੁਹਾਡੇ ਘਰ ਅਸੀਂ ਕੱਲ੍ਹ ਨੂੰ ਆ ਜਾਵਾਂਗੇ ਫਿਰ ਖਾਣਾ ਖੂਣਾ ਵੀ ਬਣਾਉਣਾ ਮੈਂ ਅੱਛਾ ਠੀਕ ਹੈ ਅਤੇ ਅੱਛਾ ਠੀਕ ਹੈ ਜੀ ਅਤੇ ਫਿਰ ਰਾਤ ਨੂੰ ਜ਼ਿਆਦਾ ਤਾਂ ਨਹੀਂ ਟਾਈਮ ਲੱਗਦਾ ਚਲੋ ਠੀਕ ਹੈ ਠੀਕ